ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਹਰ ਇੱਕ ਵਿਅਕਤੀ ਦਾ ਆਪਣਾ ਆਪਣਾ ਵੱਖ ਵੱਖ ਪ੍ਰੋਫੈਸ਼ਨ ਲਾ ਲਓ ਜਾਂ ਆਪਣੀ ਰੁਚੀ ਹੁੰਦੀ ਹੈ ਉਸੇ ਤਰ੍ਹਾਂ ਫੋਟੋਗ੍ਰਾਫੀ ਆ ਜਿਹੜੀ ਉਹ ਮੇਰੇ ਮੇਰਾ ਸਭ ਤੋਂ ਮੈਂ ਜਿਹਨੂੰ ਆਪਦੇ ਨੇੜੇ ਸਮਝਦਾ ਆਪਦੇ ਉਹ ਫੋਟੋਗ੍ਰਾਫੀ ਹੈ ਫੋਟੋਗਰਾਫੀ ਇੱਕ ਜਹੀ ਕਲਾ ਐ ਜਾਂ ਰੁਚੀ ਹੈ ਜਿਹੜੀ ਬੰਦ ਬੰਦੇ ਨੂੰ ਆਪਣੀ ਨੇਚਰ ਨਾਲ ਜੋੜਦੀ ਹੈ ਉਦਾਹਰਨ ਲਈ ਤੁਸੀਂ ਕਿਤੇ ਕਿਸੇ ਇਕਾਂਤ ਜਗ੍ਹਾ ਚ ਚਲ ਜਾਓ ਤੁਹਾਨੂੰ ਕੁਦਰਤ ਵੀ ਤੁਹਾਨੂੰ ਐਸਾ ਮਹਿਸੂਸ ਹੋਊਗਾ ਵੀ ਕੁਝ ਕਹਿਣ ਦੀ ਗੱਲ ਕਰ ਰਹੀ ਐ ਉਹਦੇ ਰਾਹੀਂ ਜੇ ਆਪਾਂ ਉਹਦੀ ਇੱਕ ਫੋਟੋਗਰਾ ਪਿੱਕ ਲੈ ਲਈਏ ਤਾਂ ਉਹ ਸਾਨੂੰ ਉਹ ਸੀਨ ਦੁਬਾਰੇ ਯਾਦ ਆ ਜਾਂਦਾ ਇਹ ਯਾਦਾਂ ਤਾਜ਼ਾ ਰੱਖਣ ਲਈ ਇੱਕ ਸਭ ਤੋਂ ਵਧੀਆ ਸਾਧਨ ਮੈਂ ਮੰਨਦਾ ਗਾ ਫੋਟੋਗ੍ਰਾਫੀ ਨੂੰ ਫੋਟੋਗ੍ਰਾਫੀ ਨੇ ਮੇਰੇ ਨਿੱਜੀ ਲਾਈਫ ਉੱਪਰ ਬਹੁਤ ਪ੍ਰਭਾਵ ਪਾਇਆ ਹੈ ਜਿਵੇਂ ਕਿ ਮੈਂ ਪਹਿਲਾਂ ਮੈਨੂੰ ਇਸ ਦਾ ਸ਼ੌਂਕ ਸ਼ੁਰੂ ਤੋਂ ਹੀ ਰਿਹਾ ਫੋਟੋਗ੍ਰਾਫੀ ਦਾ ਮੈਂ ਕੋਈ ਵੀ ਕਹਾਣੀ ਹੁੰਦੀ ਹੈ ਜਾਂ ਕੋਈ ਗੱਲਬਾਤ ਹੁੰਦੀ ਹੈ ਉਹ ਮੈਨੂੰ ਸੇਧ ਦਿੰਦੇ ਨੇ ਮੈਂ ਇਸ ਤੋਂ ਸੇਧ ਲੈਂਦਾ ਹਾਂ ਫੋ ਫੋਟੋਗ੍ਰਾਫੀ ਮੇਰੇ ਲਾਈਫ ਵਿੱਚ ਬਹੁਤ ਨਿਵੇਕਲਾ ਢੰਗ ਹੈ